ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਸੋਚਦਾ ਹਾਂ ਕਿ ਲੋਕ ਰਾਜਨੀਤਿਕ ਤਣਾਅ ਪੈਦਾ ਕਰਨ ਲਈ ਧਰਮ ਦਾ ਫਾਇਦਾ ਉਠਾਉਂਦੇ ਹਾਂ ਅਤੇ ਧਰਮ ਨੂੰ ਵਪਾਰ ਵਜੋਂ ਵਰਤਦੇ ਹਨ ਜਿਵੇਂ ਕਿ ਮੈਂ ਦੇਖਿਆ ਹੈ ਕਿ ਆਪਣੀ ਜ਼ਿੰਦਗੀ ਵਿੱਚ ਕੁਝ ਲੋਕ ਹੀ ਕਰਦੇ ਨੇ ਧਰਮ ਦਾ ਨਾਂ ਲੈ ਕੇ ਝੂਠਾ ਤਾਂ ਨਾਂ ਲਾ ਕੇ ਇੱਕ ਦੂਜੇ ਨੂੰ ਲੜਾਉਂਦੇ ਨੇ ਧਰਮ ਦਾ ਨਾਂ ਲਾ ਕੇ ਝੂਠਾ ਦਾਨ ਵੀ ਲੈ ਲੈਂਦੇ ਨੇ ਜਿਵੇਂ ਅੱਜ ਕੱਲ੍ਹ ਤਾਂ ਲੋਕਾਂ ਨੇ ਧਰਮ ਹੀ ਬਣਾ ਲਿਆ ਗਰਾਈ ਦੀ ਕਾਪੀ ਫੜ੍ਹ ਲੈਂਦੇ ਨੇ ਫਿਰ ਚੱਲ ਜਾਂਦੇ ਨੇ ਕਿਸੇ ਦੇ ਤਰ੍ਹਾਂ ਕਿਸੇ ਦੇ ਘਰ ਵੀ ਘਰ ਜਾ ਕੇ ਗਰਾਈ ਲੈਂਦੇ ਨੇ ਅਤੇ ਫਿਰ ਕੀ ਹੁੰਦਾ ਜੋ ਕੱਲ੍ਹ ਨੂੰ ਪਤਾ ਲੱਗਦਾ ਕਿ ਉਹ ਤਾਂ ਗਲਤ ਬੰਦਾ ਫਿਰ ਬੰਦੇ ਦੇ ਮਨ ਵਿੱਚ ਧਰਮ ਪ੍ਰਤੀ ਗਲਤ ਵਿਚਾਰਾਂ ਦਾ ਕੀ ਅਰਥ ਧਰਮ ਗਲਤ ਹੈ ਇਸ ਤਰ੍ਹਾਂ ਦੇ ਹੁੰਦੇ ਤਰ੍ਹਾਂ ਕਰਦੇ ਨੇ ਜਦੋਂ ਕਿ ਕਸੂਰ ਧਰਮ ਦਾ ਨਹੀਂ ਹੁੰਦਾ ਅਸੂਲ ਲੋਕਾਂ ਦਾ ਹੁੰਦਾ ਲੋਕ ਇਸ ਤਰ੍ਹਾਂ ਹੀ ਦੀ ਹਰਕਤਾਂ ਕਰਦੇ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਰਾਜਨੀਤਿਕ ਨਾਮ ਹੋ ਗਿਆ ਆਪਣਾ ਔਰ ਆਪਸ ਵਿੱਚ ਭੇਦ ਭਾਵ ਕ ਕਰਾ ਦਿੰਦੇ ਨੇ ਅਤੇ ਠੀਕ ਠੀਕ ਹੀ ਨਾ ਕਿ ਉਹ ਧਰਮ ਵਾਲਾ ਇਹਨੂੰ ਹੀ ਨਹੀਂ ਮੰਨਦਾ ਉਹ ਧਰਮ ਵਾਲਾ ਇਹਨੂੰ ਨਹੀਂ ਮੰਨਦਾ ਜਦੋਂ ਕਿ ਇੱਦਾਂ ਦਾ ਕੁਝ ਨਹੀਂ ਹੁੰਦਾ ਸਾਨੂੰ ਆਪ ਹੀ ਦੇਖਣਾ ਚਾਹੀਦਾ ਕਿ ਲੋਕ ਹੀ ਕੀ ਸੱਚੀ ਧਰਮ ਦੇ ਨਾਮ 'ਤੇ ਸਭ ਕਰ ਰਹੇ ਨੇ ਪਰ ਇਸ ਤਰ੍ਹਾਂ ਦੇ ਮੌਕੇ 'ਤੇ ਲੋਕ ਫਾਇਦਾ ਚੁੱਕਦੇ ਨੇ ਜਿਹੜੇ ਇੱਕ ਦੂਜੇ ਨੂੰ ਲੜਾਉਣ ਦੇ ਵਿੱਚ ਅੱਗੇ ਹੁੰਦੇ ਨੇ ਉਹ ਧਰਮ ਦਾ ਨਾਮ ਲੈ ਕੇ ਇੱਕ ਦੂਜੇ ਨੂੰ ਲੜਾਉਂਦੇ ਨੇ ਧੰਨਵਾਦ ਜੀ